ਮੇਰੇ ਕੋਲ ਡਰਾਇੰਗ ਵਿਸ਼ਾ ਹੈ ਜੋ ਕਿ ਬਹੁਤ ਵਧੀਆ ਵਿਸ਼ਾ ਹੈ ਇਸ ਨਾਲ ਅਸੀਂ ਹਰ ਇੱਕ ਚਿੱਤਰਕਲਾ ਨੂੰ ਬਣਾ ਸਕਦੇ ਹਾਂ ਹੌਲੀ ਹੌਲੀ ਮੈਨੂੰ ਇਸ ਵਿੱਚ ਰੁਚੀ ਹੋਣ ਲੱਗੀ ਅਤੇ ਜਿਵੇਂ ਜਿਵੇਂ ਡਰਾਇੰਗ ਕਰਦੀ ਗਈ ਮੈਂ ਉਵੇਂ ਉਵੇਂ ਹੀ ਮੇਰੀ ਇਸ ਵਿੱਚ ਕਲਾ ਹੋਰ ਵੱਧ ਗਈ ਫਿਰ ਮੈਂ ਆਪਣੇ ਹੁਨਰ ਨੂੰ ਬਹੁਤ ਨਿਖਾਰਿਆ ਅਤੇ ਪੇਂਟਿੰਗ ਕਰਨ ਲੱਗ ਗਈ ਮੈਨੂੰ ਪੇਂਟਿੰਗ ਕਰਨਾ ਬਹੁਤ ਹੀ ਪਸੰਦ ਹੈ ਮੈਂ ਜਦੋਂ ਵੀ ਵਿਹਲੀ ਹੁੰਦੀ ਹਾਂ ਤਾਂ ਸਿਰਫ ਪੇਂਟਿੰਗ ਹੀ ਕਰਦੀ ਹਾਂ ਜੋ ਕਿ ਮੈਨੂੰ ਬਹੁਤ ਹੀ ਸੌਂਕ ਵੀ ਹੈ ਅਤੇ ਪੇਂਟਿੰਗ ਮੇਰੀ ਮਨ ਪਸੰਦ ਵਿਸ਼ਾ ਵੀ ਹੈ ਇਸ ਕਰਕੇ ਮੈਂ ਆਪਣੀ ਪੇਂਟਿੰਗ ਨੂੰ ਕਰਨ ਦੀ ਕਲਾ ਨੂੰ ਹੋਰ ਵੀ ਸੁਧਾਰਿਆ ਹੈ ਮੈਂ ਹਰ ਤਰ੍ਹਾਂ ਦੀ ਪੇਟਿੰਗ ਕਰਨਾ ਪਸੰਦ ਕਰਦੀ ਹਾਂ ਜਿਵੇਂ ਕਿ ਜਾਨਵਰਜ਼ ਪੰਛੀ ਵੂਮੈਨ ਮੈਨ ਹਰ ਇੱਕ ਦੀ ਚਿੱਤਰ ਚ ਕਲਾ ਬਣਾ ਸਕਦੀ ਹਾਂ ਮੈਂ ਮੈਂ ਇਹ ਮੰਨ ਹੀ ਆ ਕਿ ਕਿਸੇ ਵੀ ਕਲਾ ਨੂੰ ਸਿੱਖਣ ਲਈ ਸਿਖਲਾਈ ਲੈਣੀ ਜ਼ਰੂਰੀ ਹੁੰਦੀ ਹੈ ਇਸ ਤਰ੍ਹਾਂ ਪੈਂਟਿੰਗ ਕਰਨ ਲਈ ਵੀ ਇੱਕ ਸਿਖਲਾਈ ਲੈਣੀ ਜ਼ਰੂਰੀ ਹੈ ਇਹ ਮੇਰਾ ਮੰਨਣਾ ਹੈ ਕਿ ਪੇਂਟਿੰਗ ਇੱਦਾਂ ਦੇ ਹੁੰਦੇ ਹਨ ਜੋ ਬਿਨਾਂ ਸਿਖਲਾਈ ਤੋਂ ਵੀ ਬਹੁਤ ਵਧੀਆ ਪੇਂਟਿੰਗ ਕਰਦੇ ਹਨ ਉਹ ਉਹਨਾਂ ਦੇ ਹੱਥ ਦਾ ਹੁਨਰ ਹੁੰਦਾ ਹੈ ਮੈਂ ਵੀ ਆਪਣੇ ਪੇਂਟਿੰਗ ਨੂੰ ਅੱਗੇ ਵਧਾਉਣਾ ਚਾਹੁੰਦੀ ਹਾਂ ਜੋ ਕਿ ਮੈਂ ਮਹਿਸੂਸ ਕਰ ਸਕਾਂ ਕਿ ਮੇਰੀ ਪੇਂਟਿੰਗ ਹੀ ਸਭ ਤੋਂ ਵਧੀਆ ਹੈ ਅਤੇ ਇਹ ਪੇਂਟਿੰਗ ਆਪਣੇ ਸਮਾਜ ਵਿੱਚ ਬਹੁਤ ਹੀ ਪ੍ਰਚਲਿਤ ਹੈ ਅਸੀਂ ਇਸ ਨੂੰ ਹੋਰ ਵੀ ਵਧਾ ਸਕਦੇ ਹਾਂ ਅਤੇ ਬਹੁਤ ਹੀ ਵਧੀਆ ਵਿਸ਼ਾ ਹੈ ਜੋ ਕਿ ਹਰ ਇੱਕ ਦੀ ਖਾਸ ਅਨੁਨਿਮਿਤੀ ਹੈ